ਸਾਡੇ ਪਿੰਡਾਂ ਵਿੱਚ ਵਿਆਹ ਵਾਲੇ ਘਰ ਵਿੱਚ ਸਭ ਤੋਂ ਪਹਿਲਾਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਂਦਾ ਹੈ ਜੋ ਪਾਠ ਕਰਵਾਇਆ ਜਾਂਦਾ ਹੈ ਅਤੇ ਦੁਪਹਿਰ ਨੂੰ ਭੋਜਨ ਖਾਇਆ ਜਾਂਦਾ ਹੈ ਜੋ ਕਿ ਇੱਕ ਟੈਂਟ ਵਿੱਚ ਜਿਸਦਾ ਪ੍ਰਬੰਧ ਕਿ ਇੱਕ ਟੈਂਟ ਵਿੱਚ ਕਰਿਆ ਜਾਂਦਾ ਹੈ ਅਤੇ ਟੈਂਟ ਵਿੱਚ ਅਲੱਗ ਅਲੱਗ ਸਟੋਲਾਂ ਲੱਗੀਆਂ ਹੁੰਦੀਆਂ ਹਨ ਖਾਣ ਪੀਣ ਦੀਆਂ ਅਤੇ ਵਿਆਹ ਵਿੱਚ ਹਲਵਾਈ ਬਹੁ ਤਾਜ਼ੀਆਂ ਤਾਜ਼ੀਆਂ ਮਿਠਾਈਆਂ ਬਣਵਾਉ ਬਣਾਉਂਦਾ ਹੈ ਅਤੇ ਰਾਤ ਉ ਉਸ ਭੋਜਨ ਖਾਣ ਤੋਂ ਬਾਅਦ ਨਾਨਕਾ ਮੇਲ ਆਉਂਦਾ ਹੈ ਅਤੇ ਨਾਨਕਾ ਮੇਲ ਆਉਣ ਤੋਂ ਬਾਅਦ ਮੜਾ ਬੰਨ੍ਹਿਆ ਜਾਂਦਾ ਹੈ ਘਰ ਵਿੱਚ ਅਤੇ ਉਹ ਤੋਂ ਬਾਅਦ ਵਿਆਹ ਵਾਲੇ ਮੁੰਡੇ ਜਾਂ ਕੁੜੀ ਦੇ ਵਟਣਾ ਲਾਇਆ ਜਾਂਦਾ ਹੈ ਨਾਨਕਿਆਂ ਦੁਆਰਾ ਫੇਰ ਰਾਤ ਨੂੰ ਲੇਡੀ ਸੰਗੀਤ ਹੁੰਦਾ ਹੈ ਜਿਸ ਵਿੱਚ ਸਾਰੇ ਆਨੰਦ ਲੈਂਦੇ ਹਨ ਨੱਚ ਨੱਚ ਕੇ ਟੱਪ ਕੇ ਫੇਰ ਰਾਤ ਨੂੰ ਸਾਰੇ ਸੌਂ ਜਾਂਦੇ ਹਨ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਨਹਾਈ ਧੋਈ ਹੁੰਦੀ ਹੈ ਨਹਾਉਣ ਧੋਣ ਤੋਂ ਬਾਅਦ ਸਾਰੇ ਸ਼ਗਨ ਕੀਤੇ ਜਾਂਦੇ ਹਨ ਮੁੰਡੇ ਜਾਂ ਕੁੜੀ ਨੂੰ ਮ ਮੁੰਡੇ ਮੁੰਡੇ ਨੂੰ ਸਿੱਧ ਦੇ ਖੇੜੇ 'ਤੇ ਮੱਥਾ ਟੇਕਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕਾਇਆ ਜਾਂਦਾ ਹੈ ਮੱਥਾ ਟੇਕਾਉਣ ਤੋਂ ਬਾਅਦ ਜੰਝ ਚੜ੍ਹਦੀ ਹੈ ਜੰਝ ਚੜ੍ਹਨ ਤੋਂ ਬਾਅਦ ਪੈਲਸ ਵਿੱਚ ਜਾ ਕੇ ਦੋ ਪਰਿਵਾਰਾਂ ਵਿਚਕਾਰ ਮੁਲਾਕਾਤ ਹੁੰਦੀ ਹੈ ਪਹਿਲੀ ਮੁਲਾਕਾਤ ਵਿੱਚ ਮਿਲਣੀਆਂ ਕਰਵਾਈਆਂ ਜਾਂਦੀਆਂ ਹਨ ਕੰਬਲ ਦੇ ਕੇ ਉਸ ਤੋਂ ਬਾਅਦ ਸਾਰੇ ਬਰਾਤੀ ਪੈਲਸ ਵਿੱਚ ਜਾ ਕੇ ਆਪਣਾ ਖਾਂ ਖਾਂਦੇ ਪੀਂਦੇ ਹਨ ਫਿਰ ਆਨੰਦ ਕਾਰਜ ਦੀ ਰਸਮ ਹੁੰਦੀ ਹੈ ਆਨੰਦ ਕਾਰਜ ਦੀ ਰਸਮ ਹੋਣ ਤੋਂ ਬਾਅਦ ਸ਼ਗਨ ਪਾਉਂਦੇ ਹਨ ਸ਼ਗਨ ਪਾਉਣ ਤੋਂ ਬਾਅਦ ਫੇਰ ਡੋਲੀ ਤੋਰ ਕੇ ਘਰੇ ਆਉਂਦੇ ਹਨ ਅਤੇ ਘਰੇ ਆ ਕੇ ਨਵੀਂ ਵਹੁਟੀ ਤੋਂ ਪਾਣੀ ਵਾਰ ਕੇ ਲਾੜੇ ਦੀ ਮਾਂ ਪੀਂਦੀ ਹੈ